ਟੈਕਸਾਂ ਤੋਂ ਭਾਵ ਹੈ ਜੋ ਪੈਸਾ ਸਾਡੀ ਇਨਕਮ ਦੇ ਵਿਚੋਂ ਕੱਟ ਕੇ ਸਰਕਾਰ ਨੂੰ ਕੁਝ ਪਰਸੈਂਟ ਜਾਂਦਾ ਹੈ ਉਸ ਨੂੰ ਅਸੀਂ ਟੈਕਸ ਕਹਿੰਦੇ ਹਾਂ ਟੈਕਸ ਜਿਹੜੇ ਹੈ ਉਹ ਦੋ ਤਰੀਕੇ ਦੇ ਹੁੰਦੇ ਹੈ ਡਾਇਰੈਕਟ ਟੈਕਸ ਅਤੇ ਇਨਡਾਇਰੈਕਟ ਟੈਕਸ ਟੈਕਸ ਉਹ ਪੈਸਾ ਹੁੰਦਾ ਹੈ ਜਿਹੜਾ ਕਿ ਸਰਕਾਰ ਦੇ ਖਾਤੇ 'ਚ ਜਾਂਦਾ ਹੈ ਪਰ ਉਹ ਜਿਹੜਾ ਪੈਸਾ ਸਰਕਾਰ ਹੈ ਉਹ ਸਾਡੇ ਹੀ ਫਾਇਦੇ ਲਈ ਵਰਤਦੀ ਹੈ ਜਿਵੇਂ ਕਿ ਰੋਡ ਬਣਾਉਣਾ ਬ੍ਰਿਜ ਬਣਾਉਣੇ ਇਹ ਸਾਰਾ ਪੈਸਾ ਜਿਹੜਾ ਉਹ ਸਾਡੇ ਹੀ ਫਾਇਦੇ ਲਈ ਵਰਤਿਆ ਜਾਂਦਾ ਹੈ ਲੋਕ ਜਿਹੜਾ ਹੈ ਟੈਕਸ ਨੂੰ ਕਿਵੇਂ ਘਟਾ ਸਕਦੇ ਹੈ ਜਿਵੇਂ ਕਿ ਉਹ ਕਿਆ ਕਰਦੇ ਹੈ ਆਪਣੀ ਇਨਕਮ ਦੇ ਵਿੱਚੋਂ ਕੁਛ ਪੈਸਾ ਜਿਹੜਾ ਆਪਣੀ ਸੇਵਿੰਗ ਦੇ ਵਿੱਚ ਲਗਾ ਲੈਂਦੇ ਹੈ ਕੁਝ ਪੈਸਾ ਉਹ ਘਰ ਘੁਰ ਖਰੀਦ ਲੈਂਦੇ ਹੈ ਤਾਂ ਇਹਨਾਂ ਚੀਜ਼ਾਂ ਕਰਨ ਨਾਲ ਉਹਨਾਂ ਦਾ ਜਿਹੜਾ ਹੈ ਟੈਕਸ ਉਹ ਘੱਟ ਜਾਂਦਾ ਹੈ ਜੇ ਕਿਸੇ ਦੀ ਇਨਕਮ ਜ਼ਿਆਦਾ ਹੈ ਤਾਂ ਉਹਦੇ 'ਤੇ ਜਿਹੜਾ ਟੈਕਸ ਉਹ ਜ਼ਿਆਦਾ ਲੱਗਦਾ ਹੈ ਟੈਕਸਾਂ ਦੇ ਅਲੱਗ ਅਲੱਗ ਰੇਟ ਹੁੰਦੇ ਹਨ ਉਹਨਾਂ ਰੇਟਾਂ ਦੇ ਹਿਸਾਬ ਨਾਲ ਹੀ ਜਿਹੜਾ ਹੈ ਸਾਡੀ ਇਨਕਮ ਦੇ ਹਿਸਾਬ ਨਾਲ ਹੀ ਜਿਹੜਾ ਇਹ ਸਰਕਾਰ ਜਿਹੜੀ ਇਹ ਟੈਕਸ ਲੈਂਦੀ ਹੈ